ਵਧੀਆ ਤੁਸੀਂ ਦੱਸੋ ਕਿੱਦਾਂ ਹੋ ਮੈਂ ਘੁੰਮ ਰਿਹਾਂ ਘਰ ਕੋਲ

ਹਾਂਜੀ ਕਿੱਧਰ ਓਕੇ ਤੁਸੀਂ ਇਦਾਂ ਕਰੋ ਜੇ ਗਾਰਡਨ ਜਾਣਾ ਆ ਤਾਂ ਆਪਣੇ ਵਣ ਚੇਤਨਾ ਪਾਰਕ ਹੈਗਾ ਆ ਬਹੁਤ ਵਧੀਆ ਆ ਗਾਰਡਨ ਉੱਥੇ ਤੁਸੀਂ ਜਾ ਸਕਦੇ ਹੋ ਨਾਲ ਹੋਰ ਵੀ ਕੋਈ ਹੈਗਾ ਆ ਬੱਚੇ ਜਾਂ ਇਕੱਲੇ ਓਕੇ ਠੀਕ ਹੈ ਓਕੇ ਤੁਸੀਂ ਫਿਰ ਉੱਥੇ ਹੀ ਜਾਓ ਵਣ ਚੇਤਨਾ ਪਾਰਕ ਬਹੁਤ ਵਧੀਆ ਪਾਰਕ ਆ ਮੈਂ ਵੀ ਉੱਥੇ ਸ਼ਾਇਦ ਟਿਕਟ ਹੋਏਗੀ ਵੀਹ ਕੁ ਰੁਪਏ ਪਰ ਪਰਸਨ ਤੁਸੀਂ ਜਾ ਕੇ ਬੱਚਿਆਂ ਨਾਲ ਇੰਜੋਏ ਕਰ ਸਕਦੇ ਹੋ ਉੱਥੇ ਤੁਹਾਨੂੰ ਬਾਏ ਬੱਸ ਵੀ ਛੋਟੀ ਜਿਹੀ ਲੱਗੀ ਹੋਈ ਆ ਬੱਚਿਆਂ ਦੇ ਬੈਠ ਕੇ ਬੱਸ ਦੇ ਵਿੱਚ ਘੁੰਮ ਸਕਦੇ ਆ ਉਹ ਦੇਖ ਸਕਦੇ ਆ ਸਾਰੇ ਬਨ ਪਾਰਕ ਪਾਰਕ ਨੂੰ ਬਹੁਤ ਵੱਡਾ ਪਾਰਕ ਆ ਨਾ ਉੱਥੇ ਫਿਰ ਇੱਦਾਂ ਅ ਹਾਂ ਰੈਸਟੋਰੈਂਟ ਵੀ ਹੈਗਾ ਆ ਖਾਣ ਪੀਣ ਲਈ ਵੀ ਹੈਗਾ ਆ ਅਤੇ ਕੀ ਕਹਿੰਦੇ ਉਹਨੂੰ ਉੱਥੇ ਤੁਸੀਂ ਜਦੋਂ ਥੱਕ ਗਏ ਖਾ ਪੀ ਸਕਦੇ ਹੋ ਬੈਠ ਸਕਦੇ ਹੋ ਹਾਂ ਫਿਰ ਉਹ ਵੀ ਡੈਮ ਵੀ ਨੇੜੇ ਹੈਗਾ ਆ ਤੁਸੀਂ ਕੀ ਕਹਿੰਦੇ ਨੇ ਚੋਹਾਲ ਡੈਮ ਜਾ ਸਕਦੇ ਹੋ ਚੋਹਾਲ ਡੈਮ ਉੱਥੇ ਉਧਰਲੇ ਪਾਸੇ ਜਾ ਸਕਦੇ ਹੋ ਉਸੇ ਰੋਡ ਹਾਂ ਉਧਰਲੀ ਸਾਈਡ ਹੀ ਆ ਉਹ ਕੀ ਕਹਿੰਦੇ ਨੂੰ ਥੋੜ੍ਹਾ ਜਿਹਾ ਦੂਰ ਪੈ ਜਾਂਦਾ ਤਿੰਨ ਚਾਰ ਕਿਲੋਮੀਟਰ ਦੂਰ ਪਰ ਉਧਰੋਂ ਤੁਹਾਨੂੰ ਈਜ਼ੀ ਪੈ ਜਾਏਗਾ ਹੈ ਨਾ ਅਤੇ ਉਹ ਹਾਂਜੀ ਹਾਂਜੀ ਤੁਸੀਂ ਜਾ ਸਕਦੇ ਹੋ ਉੱਥੇ ਹਾਂ ਬਿਲਕੁਲ ਅਤੇ ਬੱਚਿਆਂ ਨੂੰ ਉੱਥੇ ਇੰਜੋਏ ਕਰਵਾਓ ਨਾਲ ਉੱਥੇ ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜੋ ਆਸੇ ਪਾਸੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀਆਂ ਜਿੱਦਾਂ ਕਾਫੀ ਪੇੜ ਲੱਗੇ ਹੋਏ ਆ ਬਹੁਤ ਕੀਮਤੀ ਪੇੜ ਆ ਹਾਂ ਜਿੱਦਾਂ ਕਿ ਕਦਮ ਦੇ ਹੋ ਗਏ ਆਮਲਾ ਹੋ ਗਿਆ ਆਮ ਬੱਚਿਆਂ ਲਈ ਝੂਲੇ ਲੱਗੇ ਹੋਏ ਆ ਹਾਂ ਬਹੁਤ ਵਧੀਆ ਝੂਲੇ ਲੱਗੇ ਹੋਏ ਆ ਬੱਚੇ ਇੰਜੋਏ ਕਰਨਗੇ ਅਤੇ ਮੈਂ ਗਿਆ ਹੋਇਆ ਹਾਂ ਕਈ ਵਾਰ ਬੱਚਿਆਂ ਨੂੰ ਲੈ ਕੇ ਗਿਆ ਹੋਇਆ ਉੱਥੇ ਅਤੇ ਹਾਂ ਤੁਸੀਂ ਜ਼ਰੂਰ ਹਾਂਜੀ ਹਾਂ ਕੋਈ ਗੱਲ ਨਹੀਂ ਜ਼ਰੂਰ ਜੀ ਆਵਾਂਗਾ ਤੁਸੀਂ ਇੱਕ ਵਾਰ ਜਾ ਆਓ ਦੇਖ ਆਓ ਉੱਥੇ ਕਿੱਦਾਂ ਦਾ ਮਾਹੌਲ ਲੱਗਿਆ ਤੁਸੀਂ ਮੈਨੂੰ ਫਿਰ ਦੱਸਿਆ ਜੇ ਅਤੇ ਵੈਸੇ ਤਾਂ ਉੱਥੋਂ ਦਾ ਵਧੀਆ ਆ ਵਾਤਾਵਰਣ ਵੀ ਬਹੁਤ ਵਧੀਆ ਆ ਸਾਫ਼ ਸੁਥਰਾ ਆ ਉੱਥੋਂ ਦੀ ਜਿਹੜੀ ਵੀ ਹਾਂ ਮਾਹੌਲ ਸ਼ਾਂਤੀ ਆ ਉੱਥੇ ਹੋਰ ਵੀ ਫੈਮਲੀਆਂ ਬੜੀਆਂ ਆਉਂਦੀਆਂ ਨੇ ਬੱਚਿਆਂ ਨੂੰ ਲੈ ਕੇ ਅਤੇ ਸਾਫ਼ ਸਫਾਈ ਦਾ ਵੀ ਬਹੁਤ ਵਧੀਆ ਉੱਥੋਂ ਦੇ ਪ੍ਰਬੰਧਕਾਂ ਨੇ ਬਹੁਤ ਵਧੀਆ ਸਾਫ਼ ਸਫਾਈ ਰੱਖੀ ਹੋਈ ਆ ਕੋਈ ਇੱਦਾਂ ਨਹੀਂ ਕੋਈ ਤੁਹਾਨੂੰ ਗੰਦਾ ਮੰਦਾ ਨਹੀਂ ਦਿੱਸੇਗਾ ਬਹੁਤ ਵਧੀਆ ਲੱਗੇਗਾ ਤੁਹਾਨੂੰ ਉੱਥੇ ਰਹਿ ਕੇ ਹਾਂ ਅਤੇ ਫਲਾਵਰ ਹੈ ਫੁੱਲ ਵਗੈਰਾ ਵੀ ਲੱਗੇ ਹੋਏ ਨੇ ਕਾਫੀ ਉਹਨਾਂ ਨੇ ਇਹ ਫੋਟੋਆਂ ਦੇ ਲਈ ਵਿਊਜ ਵੀ ਬਣਾਏ ਹੋਏ ਨੇ ਫੋਟੋਆਂ ਕੀ ਕਹਿੰਦੇ ਨੇ ਤੁਸੀਂ ਖਿੱਚ ਸਕਦੇ ਹੋ ਆਪਣੀ ਫੈਮਲੀ ਦੇ ਨਾਲ ਜਿਹੜੀ ਕਿ ਮੈਮਰੀਜ਼ ਬਚਾਅ ਕੇ ਤੁਸੀਂ ਰੱਖ ਸਕਦੇ ਹੋ ਪਰਮਾਨੈਂਟਲੀ ਹੈ ਨਾ ਬਾਅਦ 'ਚੋਂ ਦੇਖਣ ਲਈ ਹਾਂ ਤਾਂ ਵਧੀਆ ਪਾਰਕ ਆ ਉਹ ਇੱਕ ਹਾਂ ਹਾਂਜੀ ਠੀਕ ਆ ਵਧੀਆ ਆ ਸਭ ਵਧੀਆ ਸਭ ਠੀਕ ਠਾਕ ਨੇ ਤੁਸੀਂ ਇੱਕ ਵਾਰ ਜ਼ਰੂਰ ਹਾਂ ਨਹੀਂ ਕੋਈ ਗੱਲ ਨਹੀਂ ਫਿਰ ਆਵਾਂਗਾ ਮੈਂ ਤਾਂ ਨੇੜੇ ਹੀ ਹਾਂ ਮੇਰੇ ਤਾਂ ਤੁਸੀਂ ਕੀ ਕਹਿੰਦੇ ਨੂੰ ਹਾਂਜੀ ਕੋਈ ਗੱਲ ਨਹੀਂ ਫਿਰ ਆਵਾਂਗਾ ਪਰ ਥੋੜ੍ਹਾ ਜਿਹਾ ਹੁਣ ਨਹੀਂ ਫਿਰ ਬਾਅਦ 'ਚੋਂ ਤੁਸੀਂ ਇੱਕ ਵਾਰ ਪਾਰਕ ਜ਼ਰੂਰ ਜਾ ਕੇ ਆਓ ਅਤੇ ਮੈਨੂੰ ਵੀ ਦੱਸਿਓ ਜੇ ਤੁਹਾਨੂੰ ਕਿੱਦਾਂ ਦਾ ਲੱਗਿਆ ਪਾਰਕ ਅਤੇ

ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਥੈਂਕ ਯੂ ਮੈਮ ਠੀਕ ਆ ਓਕੇ ਜੀ ਬਾਏ